ਪਾਲਤੂ ਜਾਨਵਰ ਮਨੁੱਖੀ ਜੀਵਨ ਵਿੱਚ ਕਾਫ਼ੀ ਅਹਿਮ ਰੋਲ ਅਦਾ ਕਰਦੇ ਹਨ ਜਿਵੇਂ ਕੁੱਤਾਂ ਗਾਵਾਂ ਮੱਝਾਂ ਘੋੜੇ ਆਦਿ ਮੇਰੇ ਕੋਲ ਵੀ ਇੱਕ ਕੁੱਤਾ ਰੱਖਿਆ ਹੋਇਆ ਜੋ ਕਾਫੀ ਘਰ ਦੀ ਦੇਖ ਭਾਲ ਕਰਨ ਵਿੱਚ ਸਹਾਇਤਾ ਕਰਦਾ ਹੈ ਇਸ ਤੋਂ ਇਲਾਵਾ ਮੱਝਾਂ ਗਾਵਾਂ ਸਾਨੂੰ ਦੁੱਧ ਮੁਹੱਈਆਂ ਕਰਵਾਉਦੀਆਂ ਹਨ